ਡਾਂਸ ਡਾਂਸ ਲੋਕਾਂ ਲਈ ਸਿਰਫ ਇੱਕ ਇੱਕ ਮਨੋਰੰਜਨ ਦਾ ਸਾਧਨ ਨਹੀਂ ਬਲਕਿ ਸਿਹਤਮੰਦ ਰਹਿਣ ਲਈ ਵੀ ਇੱਕ ਵਧੀਆ ਸਾਧਨ ਹੈ ਡਾਂਸ ਕਰਨ ਨਾਲ ਲੋਕ ਖੁਸ਼ ਰਹਿੰਦੇ ਹਨ ਅਤੇ ਉਨ੍ਹਾਂ ਦੀ ਐਕਸਰਸਾਈਜ਼ ਵੀ ਹੁੰਦੀ ਹੈ ਡਾਂਸ ਨਾਲ ਉਹਨਾਂ ਦੇ ਸਰੀਰ ਵਿੱਚੋਂ ਪਸੀਨਾ ਬਾਹਰ ਨਿਕਲਦਾ ਹੈ ਅਤੇ ਉਹਨਾਂ ਦੀ ਸਿਹਤ ਵੀ ਵਧੀਆ ਰਹਿੰਦੀ ਹੈ ਅਤੇ ਉਹਨਾਂ ਦੇ ਸਰੀਰ ਦੀ ਐਕਸਰਸਾਈਜ਼ ਹੁੰਦੀ ਆ ਆਮ ਤੌਰ 'ਤੇ ਲੋਕ ਰੋਜ਼ ਐਕਸਰਸਾਈਜ਼ ਨਹੀਂ ਕਰ ਸਕਦੇ ਜਿਸ ਨਾਲ ਉਹ ਡਾਂਸ ਕਰ ਸਕਦੇ ਹਨ ਡਾਂਸ ਕਰਨ ਨਾਲ ਉਹਨਾਂ ਦੇ ਸਰੀਰ ਦੀ ਐਕਸਰਸਾਈਜ਼ ਵੀ ਹੁੰਦੀ ਹੈ ਪਸੀਨਾ ਵੀ ਬਾਹਰ ਨਿਕਲਦਾ ਹੈ ਅਤੇ ਉਹਨਾਂ ਨੂੰ ਖੁਸ਼ੀ ਵੀ ਮਿਲਦੀ ਹੈ ਇਸ ਤਰੀਕੇ ਨਾਲ ਅਸੀਂ ਆਪਣੇ ਸਰੀਰ ਨੂੰ ਸਿਹਤਮੰਦ ਵੀ ਰੱਖ ਸਕਦੇ ਹਨ ਅਤੇ ਆਪਣੇ ਸਰੀਰ ਦੀ ਐਕਸਰਸਾਈਜ਼ ਵੀ ਕਰ ਸਕਦੇ ਹਨ ਅਤੇ ਸ ਆਪਣੇ ਮਨ ਮਨੋਰੰਜਨ ਲਈ ਆਪਣੇ ਮਨੋਰੰਜਨ ਲਈ ਅਸੀਂ ਡਾਂਸ ਕਰ ਸਕਦੇ ਹਨ ਆਪਣੀ ਖੁਸ਼ੀ ਲਈ ਆਪਣੇ ਸਰੀਰ ਦੀ ਸ ਸਿਹਤਮੰਦ ਲਈ ਅਸੀਂ ਡਾਂਸ ਕਰ ਸਕਦੇ ਹਨ ਇਸ ਤਰੀਕੇ ਨਾਲ ਅਸੀਂ ਆਪਣੇ ਸਰੀਰ ਨੂੰ ਸਿਹਤਮੰਦ ਰੱਖ ਸਕਦੇ ਹਨ ਅਤੇ ਆਪਣੇ ਮਨ ਨੂੰ ਵੀ ਖੁਸ਼ ਰੱਖ ਸਕਦੇ ਹਾਂ